ਹੈਲੋ ਹਾਂਜੀ ਪ੍ਰਭਜੋਤ ਵੀਰ ਕੀ ਹਾਲ ਚਾਲ ਨੇ ਵਧੀਆ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਪੀ ਐੱਚ ਡੀ ਵਧੀਆ ਚਲਦੀ ਹੈ ਜੀ ਬਸ ਉਹਦੇ ਬਾਰੇ ਪੁੱਛਣਾ ਸੀ ਤੁਹਾਡੇ ਤੋਂ ਕੁਛ ਮੈਂ ਸਕੋਲਰਸ਼ਿਪ ਬਾਰੇ ਪੁੱਛਣਾ ਸੀਗਾ ਪੀ ਐੱਚ ਡੀ ਜਿਹੜੀ ਆ ਸਕੋਲਰਸ਼ਿਪ ਸਭ ਲਈ ਹੁੰਦੀਆਂ ਨੇ ਕਿਹੜੀਆਂ ਕਿਹੜੀਆਂ ਆਪਾਂ ਲੈ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ

ਠੀਕ ਹੈ ਜੀ

ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਮਿਲਣੀ ਪੰਜ ਸਾਲ ਹੀ ਹੈ ਹਾਂਜੀ ਹਾਂਜੀ ਪੰਜ ਸਾਲਾਂ ਲਈ ਕੰਪਲੀਟ ਨਹੀਂ ਹੁੰਦੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਪੰਜ ਸਾਲ ਤੱਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹਦੇ ਲਈ ਪੇਪਰ ਦੇਣਾ ਪੈਂਦਾ ਜੀ ਆਪਾਂ ਨੂੰ ਜੇ ਆਰ ਐੱਫ ਲਈ ਹੈ ਨਾ ਜੀ

ਠੀਕ ਹਾਂ ਜਾਂ ਤਾਂ ਉੱਦਾਂ ਲੱਗ ਜੇ ਹਮ ਹਮ ਹਮ

ਠੀਕ ਹੈ ਠੀਕ ਹੈ ਠੀਕ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ

ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਮੈਂ ਇਹੀ ਪੁੱਛਣਾ ਸੀ ਜੀ ਬਾਕੀ ਆਪਾਂ ਮਿਲ ਕੇ ਕਰਦੇ ਹਾਂ ਜੀ ਗੱਲ ਹਾਂਜੀ ਹਾਂ ਠੀਕ ਆ ਮਿਹਰਬਾਨੀ ਵੀਰ ਮਿਹਰਬਾਨੀ ਓਕੇ ਜੀ